ਸਤਿ ਸ਼੍ਰੀ ਅਕਾਲ ਮੈਮ ਤੁਸੀਂ ਲਾਲਾ ਲਾਜਪਤ ਰਾਏ ਲਾਇਬ੍ਰੇਰੀ ਤੋਂ ਬੋਲ ਰਹੇ ਹੋ ਮੈਮ ਮੈਂ ਕਰਮਵੀਰ ਗੱਲ ਕਰ ਰਹੀ ਹਾਂ ਮੈਨੂੰ ਮੈਨੂੰ ਮੈਨੂੰ ਕੁੱਝ ਬੁੱਕਸ ਬਾਰੇ ਪਤਾ ਕਰਨਾ ਸੀਗਾ ਮੈਮ ਮੈਮ ਜਿਵੇਂ ਸਾਡੇ ਪੰਜਾਬ ਇਤਿਹਾਸ ਬਾਰੇ ਕੋਈ ਬੁੱਕਸ ਹੈਗੀਆਂ ਤੁਹਾਡੇ ਲਾਇਬ੍ਰੇਰੀ 'ਚ ਮੈਮ ਮੈਮ ਜਿਵੇਂ ਬਲਵੰਤ ਗਾਰਗੀ ਹੋਵੇ ਮੈਨੂੰ ਇਨ੍ਹਾਂ ਦੀਆਂ ਕੁੱਝ ਕਿਤਾਬਾਂ ਚਾਹੀਦੀਆਂ ਨੇ ਮੈਮ ਮੈਨੂੰ ਜਿਵੇਂ ਮੈਂ ਹੁਣ ਗੌਰਮੈਂਟ ਐਗਜਾਮ ਦੇ ਰਹੀ ਹਾਂ ਮੈਨੂੰ ਉਹਦੇ ਰੀਲੇਟਿਡ ਕੁੱਝ ਬੁੱਕਸ ਮਿਲ ਸਕਦੀਆਂ ਜਿਨ੍ਹਾਂ ਤੋਂ ਮੈਂ ਆਪਣੀ ਤਿਆਰੀ ਕਰ ਸਕਦੀ ਹਾਂ ਮੈਮ ਮੈਨੂੰ ਇੱਕਲੇ ਪੰਜਾਬ ਦੀ ਨਹੀਂ ਚਾਹੀਦੀ ਮੈਂ ਪੂਰੇ ਆਪਣੇ ਸੈਂਟਰ ਦਾ ਇਗਜਾਮ ਦੇਣਾ ਚਾਹੁੰਦੀ ਹਾਂ ਮੈਨੂੰ ਉਹਦੇ ਰੀਲੇਟਿਡ ਬੁੱਕ ਚਾਹੀਦੀ ਆ ਓਕੇ ਮੈਮ ਕਾਰਡ ਦਾ ਕੀ ਪ੍ਰੋਸੈਸ ਹੈ ਕੀ ਕੀ ਚਾਹੀਦਾ ਏ ਓਕੇ ਮੈਮ ਮੈਮ ਕੁੱਝ ਚਾਰਜਿਸ ਵੀ ਲੱਗੋਂਗੇ ਠੀਕ ਹੈ ਮੈਮ ਠੀਕ ਹੈ ਮੈਮ ਮੈਮ ਫ਼ਿਰ ਤੁਹਾਡੀ ਲਾਇਬ੍ਰੇਰੀ ਓਪਨ ਕਦੋਂ ਤੱਕ ਹੁੰਦੀ ਹੈ ਮੈਮ ਤੁਸੀਂ ਅਵੇਲੇਵਲ ਹੋਓਂਗੇ ਜਦੋਂ ਅਸੀਂ ਆਓਂਗੇ ਮੈਮ ਫ੍ਰੈਂਚ ਦੇ ਵਿੱਚ ਬੁੱਕਸ ਮਿਲ ਸਕਦੀਆਂ ਨੇ ਓਕੇ ਮੈਮ ਥੈਂਕ ਯੂ ਮੈਮ ਅਸੀਂ ਫਿਰ ਕੱਲ੍ਹ ਆਵਾਂਗੇ ਥੈਂਕ ਯੂ ਮੈਮ